ਕਿਸਾਨਾਂ ਦੀ ਖੁਦਕੁਸ਼ੀ ਬਾਰੇ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਮੈਂ ਵੀ ਜਿਹੜੇ ਕਿਸਾਨ ਨੇ ਗੇ ਉਹ ਖੁਦਕੁਸ਼ੀ ਕਰਦੇ ਕਿਉਂ ਨੇ ਸਾਰਾ ਦੋਸ਼ ਤਾਂ ਹੈਗਾ ਹੀ ਸਰਕਾਰਾਂ ਦਾ ਹੈਗਾ ਉਹਨਾਂ ਨੂੰ ਦ ਕਹਿੰਦੀਆਂ ਨੇ ਗੀਆਂ ਵੀ ਹਾਂਜੀ ਅਸੀਂ ਤੁਹਾਡਾ ਕਰਜ਼ਾ ਮਾਫ ਕਰ ਦੇਵਾਂਗੇ ਤੁਹਾਡੇ ਐਨੇ ਕਰਜ਼ੇ ਤੁਸੀਂ ਲੈ ਸਕਦੇ ਹੋ ਅਸੀਂ ਤੁਹਾਡਾ ਕਰਜ਼ਾ ਮਾਫ ਕਰ ਦੇਵਾਂਗੇ ਪਹਿਲਾਂ ਉਹਨਾਂ ਤੋਂ ਕਹਿ ਦਿੰਦੇ ਨੇ ਵੀ ਤੁਸੀਂ ਐਨਾ ਕਰਜ਼ਾ ਚੱਕ ਸਕਦੇ ਹੋ ਚੱਕ ਸਕਦੇ ਹੋ ਅਸੀਂ ਤੁਹਾਡੇ ਕਰਜ਼ੇ ਮਾਫ ਕਰ ਦੇਵਾਂਗੇ ਬਾਅਦ ਵਿੱਚ ਕੀ ਹੁੰਦਾ ਵੀ ਉਹਨਾਂ ਦੇ ਕਰਜ਼ੇ ਮਾਫ ਨਹੀਂ ਕੀਤੇ ਜਾਂਦੇ ਅਤੇ ਵੱਧ ਵਿਆਜ 'ਤੇ ਉਹਨਾਂ ਨੂੰ ਕਰਜ਼ਾ ਦਿੱਤਾ ਜਾਂਦਾ ਹੈਗਾ ਜਿਹਦੇ ਕਰਕੇ ਉਹ ਬਾਅਦ ਵਿੱਚ ਜਦੋਂ ਉਹ ਕਰਜ਼ੇ ਨੂੰ ਆਪਣੇ ਨੂੰ ਵਾਪਸ ਹੀ ਨਹੀਂ ਕ ਉਤਾਰ ਨਹੀਂ ਸਕਦੇ ਹੈਗੇ ਫਿਰ ਉਹਨਾਂ ਨੇ ਖੁਦਕੁਸ਼ੀ ਓ ਕਰਨੀ ਹੈ ਹੋਰ ਕੀ ਇਹੀ ਸਭ ਤੋਂ ਵੱਡਾ ਰੀਜ਼ਨ ਹੈਗਾ ਜੇ ਜਿਹੜੀ ਸਰਕਾਰਾਂ ਨੇ ਉਹਨਾਂ ਨੂੰ ਝੂਠ ਬੋਲਦੀਆਂ ਨੇ ਗੀਆਂ ਕਹਿੰਦੀਆਂ ਨੇ ਗੀਆਂ ਵੀ ਅਸੀਂ ਕਰਜ਼ੇ ਮਾਫ ਕਰ ਦੇਵਾਂਗੇ ਬਾਅਦ ਵਿੱਚ ਕਰਜ਼ੇ ਮਾਫ ਨਹੀਂ ਕਰਦੀਆਂ ਹੈਗੀਆਂ ਇਹ ਥੋੜ੍ਹੀ ਨਾ ਵੀ ਅ ਬੇਸ਼ੱਕ ਕਿਸਾਨ ਖੇਤੀ ਕਰਦੇ ਨੇਗੇ ਖੇਤੀ ਦੇ ਵਿੱਚ ਵੀ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਸਾਰੇ ਉਹਨਾਂ ਦੇ ਔਜ਼ਾਰ ਲੈ ਕੇ ਆਉਣੇ ਪੈਂਦੇ ਨੇ ਸਾਰੀ ਮਿਹਨਤ ਕਰਨੀ ਪੈਂਦੀ ਆ ਸਾਰਾ ਸਾਲ ਉਹ ਮਿਹਨਤ ਕਰਦੇ ਨੇ ਛੇ ਛੇ ਮਹੀਨੇ ਮਿਹਨਤ ਕਰਦੇ ਨੇ ਪੂਰੀ ਬਾਅਦ ਵਿੱਚ ਫਸਲ ਮੌਸਮ ਦੀ ਤਬਦੀਲੀ ਕਾਰਨ ਉਹਨਾਂ ਦੇ ਜਿਹੜੇ ਫਸਲਾਂ 'ਤੇ ਪ੍ਰਭਾਵ ਪੈਂਦਾ ਹੈਗਾ ਫਸਲਾਂ ਵਧੀਆ ਨਹੀਂ ਆਉਂਦੀਆਂ ਅਤੇ ਕਰਜ਼ੇ ਕਿੱਥੋਂ ਵਾਪਸ ਕਰਨਗੇ ਉਹ ਉੱਪਰੋਂ ਸਰਕਾਰਾਂ ਨੇ ਜਿਹੜੀਆਂ ਉਹਨਾਂ 'ਤੇ ਵੱਡਾ ਇੰਟਰਸਟ ਲਗਾ ਦਿੰਦੀਆਂ ਨੇ ਜਿਹਦੇ ਕਰਕੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਅਤੇ ਉਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਲਈ ਸਰਕਾਰ ਨੂੰ ਇਹ ਕਹਿਣਾ ਪਹਿਲੀ ਗੱਲ ਤਾਂ ਉਹਨਾਂ ਨੂੰ ਝੂਠੇ ਵਾਅਦੇ ਨਹੀਂ ਕਰਨੇ ਚਾਹੀਦੇ ਵੀ ਹਾਂ ਅਸੀਂ ਕਰਜ਼ਾ ਮਾਫ ਕਰ ਦੇਵਾਂਗੇ ਅਤੇ ਦੂਸਰੀ ਗੱਲ ਉਹਨਾਂ ਨੂੰ ਸਰਕਾਰਾਂ ਨੂੰ ਇਹ ਲਿਮਿਟ ਫਿਕਸ ਕਰਨੀ ਚਾਹੀਦੀ ਵੀ ਹਾਂ ਜਿਹੜੇ ਛੋਟੇ ਪੱਧਰ ਦੇ ਕਿਸਾਨ ਜਾਂ ਵੱਡੇ ਪੱਧਰ ਦੇ ਕਿਸਾਨ ਨੇ ਗੇ ਪੈਮਾਨੇ ਦੇ ਉਹਨਾਂ ਨੂੰ ਇੱਕ ਲਿਮਿਟ ਫਿਕਸ ਕਰ ਦਿਉ ਵੀ ਹਾਂ ਤੁਸੀਂ ਐਨਾ ਇੱਥੋਂ ਤੱਕ ਆਪਣਾ ਵਿਆਜ 'ਤੇ ਪੈਸੇ ਲੈ ਸਕਦੇ ਹੋ ਤੁਹਾਨੂੰ ਐਨਾ ਵਿਆਜ ਲੱਗੇਗਾ ਉਹਨਾਂ ਦੇ ਵਿਆਜ ਦਾ ਰੇ ਦਰ ਆ ਜਿਹੜੀ ਉਹ ਘੱਟ ਕਰਨੀ ਚਾਹੀਦੀ ਆ ਅਤੇ ਐਨੀ ਲਿਮਿਟ ਤੱਕ ਤੁਸੀਂ ਕਰਜ਼ਾ ਚੱਕ ਸਕਦੇ ਹੋ ਅਤੇ ਜਦੋਂ ਤੱਕ ਤੁਹਾਡਾ ਕਰਜ਼ਾ ਪੂਰਾ ਵਾਪਸ ਨਹੀਂ ਆਉਂਦਾ ਹੈਗਾ ਉਦੋਂ ਤੱਕ ਤੁਸੀਂ ਅੱਗੇ ਹੋਰ ਕਰਜ਼ਾ ਨਹੀਂ ਚੱਕ ਸਕਦੇ ਕਿਉਂਕਿ ਜਿਹੜੇ ਕਿਸਾਨ ਨੇਗੇ ਉਹ ਕਰਜ਼ਾ ਚੱਕੀ ਜਾਂਦੇ ਨੇ ਵੀ ਇਸ ਉਮੀਦ ਦੇ ਵਿੱਚ ਵੀ ਹਾਂ ਸਰਕਾਰ ਨੇ ਕਿਹਾ ਮਾਫ ਕਰ ਦੇਣਗੇ ਪਰ ਨਹੀਂ ਹੈ ਇਹੋ ਜਿਹੀਆਂ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਉਹਨਾਂ ਨੂੰ ਜਿੰਨਾ ਪਹਿਲਾਂ ਕਰਜ਼ਾ ਲਿਆ ਹੈਗਾ ਪਹਿਲਾਂ ਉਹ ਮਾ ਉਤਾਰਨ ਆਪਣਾ ਉਸ ਤੋਂ ਬਾਅਦ ਹੋਰ ਕਰਜ਼ਾ ਲੈਣ